ਮਨੁੱਖ ਦੇ ਜੀਵਨ ਤੋਂ ਦਸਵੀਂ ਸਦੀ ਤੱਕ ਦਾ ਭਾਰਤ ਦਾ ਇਤਿਹਾਸ ਪ੍ਰਾਚੀਨ ਭਾਰਤ ਦਾ ਇਤਿਹਾਸ ਅਖਵਾਉਂਦਾ ਹੈ ਜਿਸ ਤੋਂ ਬਾਅਦ ਦੇ ਸਮੇਂ ਨੂੰ ਮੱਧਕਾਲ ਭਾਰਤ ਕਿਹਾ ਜਾਂਦਾ ਹੈ ਜਿਸ ਵਿੱਚ ਮੁਗਲਾਂ ਦਾ ਦਬਦਬਾ ਸੀ ਛੇ ਛੇਵੀਂ ਯੂਪੀ ਸਦੀ ਦੀ ਚੌਥੀ ਸਦੀ ਵਿੱਚ ਚੰਦਰਗੁਪਤ ਮੋਰੀਆ ਨੇ ਪੱਛਮੀ ਭਾਰਤ ਨੂੰ ਯੂਨਾਨੀ ਸ਼ਾਸਕਾਂ ਤੋਂ ਆਜ਼ਾਦ ਕਰਵਾਇਆ ਉਸ ਇਸ ਤੋਂ ਬਾਅਦ ਉਸਨੇ ਆਪਣਾ ਧਿਆਨ ਮਗਧ ਵਿੱਚ ਕੇਂਦਰ ਕੀਤਾ ਜਿਸ ਉੱਪਰ ਨੰਦਾ ਦਾ ਰਾਜ ਸੀ ਚੰਦਰਗੁਪਤ ਮੋਰੀਆ ਤੋਂ ਬਾਅਦ ਬਿੰਦੂਸਾਰ ਦੇ ਪੁੱਤਰ ਅਸ਼ੋਕ ਨੇ ਮੋਰੀਆ ਵੰਸ਼ ਨੂੰ ਆਪਣੇ ਸਿਖਰ ਉੱਤੇ ਪਹੁੰਚਾ ਦਿੱਤਾ